ਰੂਪਨਗਰ ਸ਼ਹਿਰ ਉਦਯੋਗਿਕ ਵਿਕਾਸ ਕਾਰੋਬਾਰ ਦਾ ਬਹੁਤ ਵੱਡਾ ਕੇਂਦਰ ਹੈ ਇੱਥੇ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਵਪਾਰ ਜੋ ਹੈ ਪ੍ਰਚਿਲਤ ਹੈ ਇੱਥੇ ਮੰਡੀ ਵਪਾਰ ਮੰਡੀ ਹੈ ਅਤੇ ਉਦਯੋਗ ਇੱਥੇ ਦਵਾਈਆਂ ਦੀਆਂ ਫੈਕਟਰੀਆਂ ਹਨ ਇਸ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਫੈਕਟਰੀਸ ਹਨ ਅੰਬੂਜਾ ਸੀਮਿੰਟ ਫੈਕਟਰੀ ਪੂਰੇ ਇੰਡੀਆ ਵਿੱਚ ਫੇਮਸ ਹੈ ਅਤੇ ਇੱਥੋਂ ਦਾ ਸੀਮਿੰਟ ਸਾਰੇ ਇੰਡੀਆ ਵਿੱਚ ਜਾਂਦਾ ਹੈ ਸਵਰਾਜ ਮਾਜਡਾ ਵਿੱਚ ਬਣੀਆਂ ਗੱਡੀਆਂ ਪੂਰੇ ਭਾਰਤ ਵਿੱਚ ਘੁੰਮਦੀਆਂ ਆਮ ਨਜ਼ਰ ਆ ਜਾਂਦੀਆਂ ਹਨ ਅਤੇ ਇੱਥੇ ਜੋ ਹੈ ਬਹੁਤ ਲੋਕਾਂ ਨੂੰ ਰੂਪਨਗਰ ਦੇ ਲੋਕਾਂ ਨੂੰ ਤਾਂ ਕਾਰੋਬਾਰ ਮਿਲਿਆ ਹੀ ਹੈ ਇਸ ਦੇ ਨਾਲ ਨਾਲ ਬਾਹਰੋਂ ਦੂਜੀਆਂ ਸਟੇਟਸ ਤੋਂ ਆ ਕੇ ਵੀ ਲੋਕ ਜੋ ਹੈ ਇੱਥੇ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ ਕਮਾ ਰਹੇ ਹਨ ਇੱਥੇ ਇੰਨਾ ਇਸ ਦੇ ਨਾਲ ਜਿੱਥੇ ਰੂਪਨਗਰ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ ਉੱਥੇ ਇੱਥੇ ਹੋਰ ਵਿਕਾਸ ਦੇ ਮੌਕੇ ਵੱਧ ਰਹੇ ਹਨ ਅਤੇ ਪਰ ਮੁਸ਼ਕਿਲ ਇਹ ਆ ਰਹੀ ਹੈ ਕਿ ਇਸ ਦੇ ਨਾਲ ਜਿੱਥੇ ਵਾਤਾਵਰਨ ਗੰਧਲਾ ਹੋ ਰਿਹਾ ਹੈ ਉੱਥੇ ਪਾਣੀ ਜਾਂ ਧਰਤੀ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਲਈ ਰਹਿਣਾ ਜੋ ਹੈ ਮੁਹਾਲ ਹੋ ਰਿਹਾ ਹੈ ਅਤੇ ਇਸ ਤੋਂ ਬਿਨਾਂ ਇੱਥੇ ਜੋ ਸਵਰਾਜ ਮਾਜਦਾ ਫੈਕਟਰੀ ਹੈ ਉਸ ਦੇ ਵਿੱਚ ਵੀ ਬਹੁਤ ਸਾਰੇ ਇਲਾਕੇ ਦੇ ਲੋਕ ਜੋ ਹੈ ਇਲਾਕੇ ਦੇ ਬੱਚੇ ਉਹ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ ਕਮਾ ਰਹੇ ਹਨ ਇਸ ਤੋਂ ਬਿਨਾਂ ਜੋ ਇਲਾਕੇ ਵਿੱਚ ਕਾਰੋਬਾਰ ਹੈ ਬਜ਼ਾਰ ਬਹੁਤ ਵੱਡੇ ਹਨ ਅਤੇ ਉੱਥੇ ਸਾਰਾ ਜ਼ਰੂਰਤ ਦਾ ਸਮਾਜ ਜੋ ਹੈ ਮੁਹੱਈਆ ਹੋ ਜਾਂਦਾ ਹੈ ਅਤੇ ਲੋਕਾਂ ਦੇ ਲਈ ਇੱਕ ਰੋਜ਼ੀ ਦਾ ਉੱਤਮ ਸਾਧਨ ਵੀ ਇਹ ਕਾਰੋਬਾਰ ਹਨ